ਸਾਡੇ ਪੰਜਾਬ ਦੀਆਂ ਕਈ ਖੇਡਾਂ ਹਨ ਜੋ ਅੰਤਰਰਾਸ਼ਟਰੀ ਪੱਧਰ 'ਤੇ ਖੇਡੀਆਂ ਜਾਂਦੀਆਂ ਹਨ ਇਹਨਾਂ ਖੇਡਾਂ ਨੂੰ ਦੇਸ਼ ਵਿਦੇਸ਼ ਵਿੱਚ ਵੀ ਮਾਨਤਾ ਦਿੱਤੀ ਗਈ ਹੈ ਸਾਡੇ ਇਕੱਲੇ ਪੰਜਾਬ ਦੀਆਂ ਹੀ ਨਹੀਂ ਹੋਰ ਸਟੇਟਾਂ ਦੀਆਂ ਖੇਡਾਂ ਵੀ ਹਨ ਜੋ ਅੰਤਰਰਾਸ਼ਟਰੀ ਪੱਧਰ 'ਤੇ ਖੇਡੀਆਂ ਜਾਂਦੀਆਂ ਹਨ ਭਾਰਤ ਵਿੱਚ ਕਬੱਡੀ ਹਾਕੀ ਫੁੱਟਬਾਲ ਵਾਲੀਬਾਲ ਨਿਸ਼ਾਨੇਬਾਜ਼ੀ ਖੋ ਖੋ ਕ੍ਰਿਕਟ ਟੈਨਿਸ ਟੇਬਲ ਟੈਨਿਸ ਸ਼ਤਰੰਜ ਚਿੜੀ ਛਿੱਕਾ ਤੈਰਾਕੀ ਜਿਮਨਾਸਟਿਕ ਖੇਡਾਂ ਆਦਿ ਹੋਰ ਵੀ ਕਈ ਖੇਡਾਂ ਹਨ ਜੋ ਖੇਡੀਆਂ ਜਾਂਦੀਆਂ ਹਨ ਕਬੱਡੀ ਖੋ ਖੋ ਸਾਡੇ ਪੰਜਾਬ ਦੀ ਖੇਡ ਹੈ ਇਹ ਖੇਡ ਵਿਦੇਸ਼ਾਂ ਤੱਕ ਪਹੁੰਚ ਚੁੱਕੀ ਹੈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਜੋ ਸਾਡੀਆਂ ਪੁਰਾਣੀਆਂ ਖੇਡਾਂ ਅਲੋਪ ਹੋ ਰਹੀਆਂ ਸਨ ਉਹਨਾਂ ਦਾ ਪਸਾਰ ਅੰਤਰਰਾਸ਼ਟਰੀ ਪੱਧਰ 'ਤੇ ਹੋ ਰਿਹਾ ਹੈ